ਹਾਂਜੀ ਮੈਂ ਸਕੂਲ ਵਿੱਚ ਪੜ੍ਹਾਈ ਕੀਤੀ ਸੀ ਜੋ ਕਿ ਵਧੀਆ ਰਹੀ ਅਤੇ ਜਦੋਂ ਮੈਂ ਸਕੂਲ ਵਿੱਚ ਪੜ੍ਹਦੀ ਸੀ ਅਤੇ ਉਸ ਟਾਈਮ ਮੈਂ ਕਢਾਈ ਬਹੁਤ ਅੱਛੀ ਕੱਢਦੀ ਸੀ ਅਤੇ ਹੋਰ ਸਕੂਲ ਵਿੱਚ ਕਢਾਈ ਅਤੇ ਗੇਮਾਂ ਵਗੈਰਾ ਵੀ ਖੇਲਾਈਆਂ ਜਾਂਦੀਆਂ ਸੀ ਜੋ ਕਿ ਵਧੀਆ ਸੀ ਕਬੱਡੀ ਕਬੱਡੀ ਬਹੁਤ ਜ਼ਿਆਦਾ ਖੇਡੀ ਅਤੇ ਉਹਦਾ ਵਧੀਆ ਰਿਹਾ ਅਤੇ ਉਹ ਸਭ ਤੋਂ ਵਧੀਆ ਸੀ